ਰਾਜਨੀਤਿਕ ਲੋਕ ਧਰਮ ਤਣਾਅ ਪੈਦਾ ਕਰਨ ਲਈ ਧਰਮ ਦਾ ਬਹੁਤ ਫ਼ਾਇਦਾ ਚੁੱਕਦੇ ਨੇ ਜਿਵੇਂ ਕਿ ਧਰਮਾਂ ਵਿੱਚ ਲੜਾਈ ਕਰਵਾ ਕੇ ਹਿੰਦੂ ਹੋ ਗਏ ਮੁਸਲਮਾਨ ਸਿੱਖ ਇਸਾਈ ਇਹਨਾਂ ਵਿੱਚ ਦੰਗੇ ਫਸਾਦ ਕਰਵਾ ਕੇ ਉਹ ਆਪ ਦਾ ਬਹੁਤ ਫ਼ਾਇਦਾ ਚੁੱਕਦੇ ਨੇ ਵੋਟਾਂ ਦਾ ਵੋਟਾਂ ਦੇ ਫ਼ਾਇਦੇ ਲਈ ਸਾਰਾ ਕੁਝ ਕਰਦੇ ਨੇ ਵੋਟਾਂ ਨੂੰ ਆਪਣਾ ਵਪਾਰ ਬਣਾਇਆ ਹੋਇਆ ਇਹਨਾਂ ਨੇ ਬਹੁਤ ਸਾਰੇ ਉਹ ਤਣਾਅ ਪੈਦਾ ਕਰਦੇ ਨੇ ਰਾਜਨੀਤਿਕ ਲੋਕ ਦੂਜੇ ਧਰਮਾਂ ਨੂੰ ਮੰਦਰ ਹੋ ਗਏ ਮਸਜਿਦ ਹੋ ਗਏ ਢਾ ਦਿੰਦੇ ਨੇ ਫਿਰ ਲੜਾਈਆਂ ਕਰਵਾਉਂਦੇ ਨੇ ਇੱਦਾ ਹੀ ਗੁਰਦੁਆਰੇ ਹੋ ਗਏ ਗੁਰਦੁਆਰਿਆਂ 'ਚ ਜੋ ਚੜਾਵਾ ਚੜਦਾ ਆ ਉਹਨਾਂ ਦੇ ਪੈਸੇ ਜਿਹੜੇ ਚੜਾਵਾ ਚੜਦਾ ਵਾ ਉਹ ਆਪਣੇ ਵੋਟਾਂ ਵਿੱਚ ਲਾਉਂਦੇ ਨੇ ਰੈਲੀਆਂ ਕਰਵਾਉਂਦੇ ਨੇ ਅਤੇ ਉਹ ਪੈਸਾ ਸਾਰਾ ਇਹਨਾਂ ਵਿੱਚ ਹੀ ਵਰਤਦੇ ਨੇ ਅਤੇ ਆਪਣੇ ਰਾਜਨੀਤਿਕ ਲੋਕ ਦੂਜਿਆਂ ਨੂੰ ਲੜਾਈਆਂ ਵਿੱਚ ਲੜਾਈਆਂ ਬਹੁਤ ਜਾਣੀਆਂ ਕਰਵਾਉਂਦੇ ਨੇ